ਮੇਰੇ ਕੋਲ ਕੈਨਨ ਦਾ ਕੈਮਰਾ ਹੈ ਇਹ ਦੋ ਹਜ਼ਾਰ ਡੀ ਹੈ ਇਸ ਨਾਲ ਮੈਨੂੰ ਦੋ ਲੈਂਜ ਮਿਲੇ ਹਨ ਇੱਕ ਹੈ ਅਠਾਰਾਂ ਪੈਂਤੀ ਦੂਸਰਾ ਹੈ ਪਚੱਤਰ ਤਿੰਨ ਸੌ ਇਹਨਾਂ ਨਾਲ ਦੂਰ ਤੋਂ ਦੂਰ ਨੇੜੇ ਦੀ ਫੋਟੋ ਲਾ ਸਕਦੇ ਹਾਂ